ਡਾਂਸ ਇੱਕ ਕਲਾ ਹੈ ਜਿਹੜਾ ਇਹ ਕਲਾ ਹਰ ਇੱਕ ਬੰਦੇ ਦੇ ਵਿੱਚ ਹੁੰਦੀ ਹੈ ਜੇ ਇਹ ਜਿਹੜਾ ਡਾਂਸ ਹੈ ਇਹ ਹਰ ਕਿਸੇ ਵੀ ਤਿਉਹਾਰ ਜਾਂ ਸਮਾਗਮ ਅੱਜ ਕੱਲ੍ਹ ਇਹ ਵਿਆਹ ਸ਼ਾਦੀਆਂ 'ਤੇ ਵੀ ਕੀਤਾ ਜਾਂਦਾ ਏ ਚਾਹੇ ਉਹ ਮੁੰਡੇ ਦਾ ਵਿਆਹ ਏ ਕੁੜੀ ਦਾ ਵਿਆਹ ਏ ਗਿੱਧਾ ਭੰਗੜਾ ਵਿਆਹਾਂ 'ਤੇ ਬਹੁਤ ਪਾਇਆ ਜਾਂਦਾ ਏ ਅਤੇ ਲੋਹੜੀਆਂ ਲੋਹੜੀ ਵੀ ਬਹੁਤ ਵਧੀਆ ਗਿੱਧੇ ਭੰਗੜੇ ਨਾਲ਼ ਐਨ ਧੂਮ ਧਾਮ ਨਾਲ਼ ਮਨਾਈ ਜਾਂਦੀ ਹੈ ਅਤੇ ਅਤੇ ਸਾਡੇ ਪਿੰਡ ਵਿੱਚ ਡਾਂਸ ਦੀ ਬਹੁਤ ਮਹੱਤਵਪੂਰਨ ਮਹੱਤਵਪੂਰਨ ਮਹੱਤਵਪੂਰਨ ਹੈ ਕਿਉਂਕਿ ਜਦੋਂ ਵੀ ਸਾਉਣ ਦਾ ਮਹੀਨਾ ਆਉਂਦਾ ਏ ਸਾਉਣ ਦਾ ਮਹੀਨੇ ਨੂੰ ਤੀਆਂ ਦੇ ਤਿਉਹਾਰ ਨਾਲ਼ ਜਾਣਿਆ ਜਾਂਦਾ ਏ ਕੁੜੀਆਂ ਆਪਣੇ ਹੱਥਾਂ 'ਤੇ ਮਹਿੰਦੀਆਂ ਲਾਂਦੀਆਂ ਇਕੱਠੀਆਂ ਹੋ ਕੇ ਪੀਂਘਾ ਪਾ ਕੇ ਪੀਂਘਾ ਝੂਟਦੀਆਂ ਗਿੱਧੇ ਪਾਉਂਦੀਆਂ ਭੰਗੜਾ ਪਾਉਂਦੀਆਂ ਆਪਣੀ ਜਿਹੜੇ ਜਿਹੜਾ ਸਾਉਣ ਮਹੀਨਾ ਇਹਦਾ ਪੂਰਾ ਆਨੰਦ ਲੈਂਦੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਆ ਕੇ ਪੂਰੇ ਆਪਣੀ ਜਿਹੜੇ ਚਾਅ ਪੂਰੇ ਕਰਦੀਆਂ ਗਿੱਧੇ ਦੇ ਭੰਗੜੇ ਦੇ ਮਹਿੰਦੀਆਂ ਲਾਂਦੀਆਂ ਚੂੜੀਆਂ ਪਾਉਂਦੀਆਂ ਨਵੇਂ ਨਵੇਂ ਕੱਪੜੇ ਖਰੀਦ ਦੀਆਂ ਅਤੇ ਇਸ ਤਰ੍ਹਾਂ ਜਿਹੜਾ ਅਤੇ ਲੋਹੜੀ 'ਤੇ ਵੀ ਸਾਰਾ ਕੁਛ ਇੱਦਾਂ ਈ ਹੁੰਦਾ ਏ ਅਤੇ ਜਿਹੜਾ ਸ ਜਿਹੜਾ ਡਾਂਸ ਹੈ ਇਹ ਖੁਸ਼ੀ ਦਿੰਦਾ ਹਰ ਇੱਕ ਬੰਦੇ ਨੂੰ ਅੰਦਰੋਂ ਜਦੋਂ ਬੰਦਾ ਕੋਈ ਵੀ ਡਾਂਸ ਕਰਦਾ ਏ ਜਾਂ ਕੁਛ ਵੀ